ਹਾਂਜੀ ਕਿਸਾਨ ਟ੍ਰੇਡਰ ਮੋਹਾਲੀ ਤੋਂ ਗੱਲ ਕਰ ਰਹੇ ਹੋ ਮੈਂ ਗੁਰਸੇਵਕ ਸਿੰਘ ਗੱਲ ਕਰ ਰਿਹਾ ਜੀ ਸ਼੍ਰੀ ਮਾਨ ਜੀ ਮੈਂ ਨਾ ਤੁਹਾਡੇ ਕੋਲ਼ੋਂ ਪਿੱਛਲੇ ਮਹੀਨੇ ਇੱਕ ਕੂਲਰ ਦਾ ਔਡਰ ਕੀਤਾ ਸੀ ਅਤੇ ਬੜੀ ਮੈਨੂੰ ਦੁੱਖ ਨਾਲ਼ ਕਹਿਣਾ ਪੈ ਰਿਹਾ ਕਿ ਇਹ ਮੇਰੇ ਔਡਰ ਕਰਨ ਤੋਂ ਤਕਰੀਬਨ ਵੀਹ ਦਿਨ ਬਾਅਦ ਮੈਨੂੰ ਇਹ ਕੂਲਰ ਮਿਲਿਆ ਪਰ ਜਦੋਂ ਮੈਂ ਉਹਦੀ ਕੂਲਰ ਦੀ ਪੈਕਿੰਗ ਖੋਲ੍ਹੀ ਤਾਂ ਕੂਲਰ ਦੀ ਜਿਹੜੀ ਪਲਾਸਟਿਕ ਦੀ ਬੌਡੀ ਹੈ ਉਹ ਕਈ ਜਗ੍ਹਾ ਤੋਂ ਟੁੱਟੀ ਹੋਈ ਸੀ ਔਰ ਉਹਦੇ ਵਿੱਚ ਕਈ ਥਾਵਾਂ 'ਤੇ ਸਕਰੈਚ ਪਏ ਹੋਏ ਸੀ ਬੜਾ ਮਨ ਨੂੂੰ ਦੁੱਖ ਹੋਇਆ ਚਲੋ ਉਸ ਤੋਂ ਬਾਅਦ ਜਦੋਂ ਕੂਲਰ ਇਹ ਚੱਲਦਾ ਤਾਂ ਇੱਕ ਤਾਂ ਇਹਦੀ ਜਿਹੜੀ ਆਵਾਜ਼ ਹੈ ਆਵਾਜ਼ ਬਹੁਤ ਜ਼ਿਆਦਾ ਕਰਦਾ ਜਦੋਂ ਚੱਲਦਾ ਕੂਲਰ ਇਹ ਤਾਂ ਇਹਦੀ ਆਵਾਜ਼ ਦੇ ਨਾਲ਼ ਬਹੁਤ ਸਾਰੀ ਸ਼ੌਰ ਹੁੰਦਾ ਹੈ ਨੰਬਰ ਦੋ ਜਿਹੜੀ ਇਹ ਕੂਲਰ ਦੀ ਪਾਣੀ ਵਾਲ਼ੀ ਮੋਟਰ ਹੈ ਉਹ ਮੋਟਰ ਵੀ ਬਿਲਕੁਲ ਨਹੀਂ ਚੱਲ ਰਹੀ ਮੈਂ ਇਹ ਮਕੈਨਿਕ ਨੂੰ ਵੀ ਦਿਖਾਈ ਸੀ ਉਹ ਕਹਿੰਦਾ ਜੀ ਮੋਟਰ ਇਹ ਖ਼ਰਾਬ ਹੈ ਤੁਹਾਡੇ ਨਾਲ਼ ਇਹ ਜਿਹੜਾ ਹੈਗਾ ਕੂਲਰ ਤੁਹਾਨੂੰ ਪ੍ਰੋਡਕਟ ਬਹੁਤ ਗ਼ਲਤ ਮਿਲਿਆ ਅਤੇ ਤੁਸੀਂ ਕੰਪਨੀ ਨਾਲ਼ ਗੱਲ ਕਰਕੇ ਇਹਨੂੰ ਦੁਵਾਰੇ ਵਾਪਿਸ ਕਰੋ ਸੋ ਸ਼੍ਰੀਮਾਨ ਜੀ ਬੇਨਤੀ ਹੈ ਮੈਂ ਇੰਨਾ ਮਹਿੰਗਾ ਕੂਲਰ ਤੁਹਾਡੇ ਕੋਲ਼ੋਂ ਖਰੀਦਿਆ ਔਰ ਮੈਂ ਤੁਹਾਡੀ ਜਿਹੜੀ ਇਸ ਕੁੱਲਰ ਦੀ ਉਤਪਾਦ ਤੋਂ ਮੈਂ ਸੰਤੁਸ਼ਟ ਨਹੀਂ ਕ੍ਰਿਪਾ ਕਰਕੇ ਜਿਹੜਾ ਮੇਰਾ ਕੂਲਰ ਜਾਂ ਤਾਂ ਇਹਨੂੰ ਰਿਪਲੇਸ ਕਰਕੇ ਮੈਨੂੰ ਬਦਲੀ ਕਰਕੇ ਦਿਉ ਜਾਂ ਫਿਰ ਜਿੰਨਾਂ ਇਹ ਡੈਮਿਜ ਹੋਇਆ ਵਾ ਮੈਨੂੰ ਇਹਦੀ ਰਿਪੇਅਰ ਕਰਕੇ ਦਿਓ ਧੰਨਵਾਦ